ਹਾਂ ਮੈਂ ਕਈ ਵਾਰ ਵਿਭਿੰਨ ਮੀਟਿੰਗਾਂ ਅਤੇ ਰਿਮੋਟ ਕੰਮ ਲਈ ਵੀਡੀਓ ਕਾਨਫਰੰਸਾਂ ਐਪਲੀਕੇਸ਼ਨ 'ਤੇ ਇਸਤੇਮਾਲ ਕੀਤੀਆਂ ਹੈ ਕੀਤੀ ਹੈ ਕੀਤਾ ਹੈ ਖਾਸ ਕਰਕੇ ਜਦੋਂ ਮੈਨੂੰ ਕਿਸੇ ਨਾਲ ਜੋੜਨ ਜੋੜਨ ਜਾਂ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਲੋੜ ਹੁੰਦੀ ਹੈ ਮੇਰਾ ਮੇਰਾ ਤਜਰਬਾ ਕਾਫੀ ਮਿਲ ਮਿਲਾ ਜੁਲਾ ਰਿਹਾ ਹੈ ਕੁਝ ਮੀਟਿੰਗਾਂ ਵਿੱਚ ਸਭ ਕੁਝ ਬਹੁਤ ਆਸਾਨ ਅਤੇ ਸੁਚੱਜਾ ਰਿਹਾ ਪਰ ਕੁਝ ਮੂਲ ਤੱਤਾਂ ਨੇ ਸਹੀ ਤਰ੍ਹਾਂ ਕੰਮ ਨਹੀਂ ਕੀਤਾ ਜਦੋਂ ਮੈਂ ਜਦੋਂ ਮੈਂ ਐਪਲੀਕੇਸ਼ਨ ਜਿਵੇਂ ਕਿ ਜ਼ੂਮ ਗੂਗਲ ਮੀਟ ਅਤੇ ਮਾਈਕਰੋ ਸੋਫ ਟੀਮ ਵਰਗੀਆਂ ਸੇਵਾਵਾਂ ਦੀ ਵਰਤੋਂ ਕੀਤੀ ਤਾਂ ਮੈਂ ਦੇਖਿਆ ਕਿ ਇਹ ਜਨਰਲ ਤੌਰ 'ਤੇ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ ਹਨ ਇਹ ਸਧਾਰਨ ਅਤੇ ਆਸਾਨ ਇ ਇੰਟਰ ਇੰਟਰਫੇਸ ਚੈਟ ਸਕਰੀਨ ਸ਼ੇਅਰਿੰਗ ਅਤੇ ਰਿਕਾਡਿੰਗ ਜਿਵੇਂ ਫੀਚਰਾਂ ਨਾਲ ਅ ਆਉਂਦੀ ਹਨ ਆਉਂਦੀਆਂ ਹਨ ਜੋ ਵਿਦਿਆਰਥੀਆਂ ਟੀਮ ਮੈਂਬਰਾਂ ਜਾਂ ਜਾਂ ਮੇਸ਼ ਵੇਜ਼ ਵੈਸ਼ਨੇਸ਼ ਪ੍ਰੋ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਲਈ ਬਹੁਤ ਫਾਇਦੇਮੰਦ ਹਨ ਰ ਰਿਮੋਟ ਕੰਮ ਦੇ ਦੇ ਹਾਲਤ ਵਿੱਚ ਇਹ ਐਪਸ ਇੱਕ ਦੂਜੇ ਨਾਲ ਕੰਟਰੋਲ ਕਰਨ ਅਤੇ ਸੰਚਾਰ ਦੇ ਤਰੀਕੇ ਨੂੰ ਬਿਹਤਰ ਬਣਾਉਂਦੇ ਹਨ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਮੇਰਾ ਇਹ ਟੋਪਿਕ ਚੰਗਾ ਲੱਗੇਗਾ ਧੰਨਵਾਦ